ਹੈਲੋ ਸਤਿ ਸ਼੍ਰੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਅੰਜਲੀ ਬੋਲ ਰਹੀ ਹਾਂ ਤੁਸੀਂ ਕੌਣ ਹਾਂਜੀ ਹਾਂਜੀ ਹਾਂਜੀ ਉਹ ਹੀ ਹਾਂ ਦੱਸੋ ਜੀ ਓਕੇ ਜੀ ਕਿੰਨਾ ਵਜ਼ਨ ਹੈ ਤੁਹਾਡਾ ਨਹੀਂ ਨਹੀਂ ਮੈਮ ਇੰਨਾ ਤਾਂ ਇੰਨਾ ਇੰਨੀ ਛੇਤੀ ਨਹੀਂ ਹੋ ਸਕਦਾ ਜੇ ਤੁਸੀਂ ਕਿੰਨੇ ਕੁ ਟਾਈਮ ਕਿੰਨਾ ਘੱਟ ਕਰਨਾ ਮੈਮ ਹੋ ਤਾਂ ਸਕਦਾ ਬਟ ਮੈਂ ਤੁਹਾਨੂੰ ਇਹ ਦੱਸਣਾ ਚਾਹੂੰਗੀ ਕਿ ਇੰਨਾ ਵੇਟ ਘੱਟ ਕਰਨਾ ਇੰਨੇ ਥੋੜ੍ਹੇ ਮਹੀਨਿਆਂ ਦੇ ਵਿੱਚ ਠੀਕ ਨਹੀਂ ਹੁੰਦਾ ਕਿਉਂਕਿ ਆਪਣੀ ਬਾਡੀ 'ਤੇ ਇਫ਼ੇਕ੍ਟ ਪਵੇਗਾ ਇਸ ਚੀਜ਼ ਦਾ ਅਤੇ ਜਿੰਨਾ ਮੈਂ ਉਸ ਤੋਂ ਵੱਧੋ ਵੱਧ ਆਪਾਂ ਕੋਸ਼ਿਸ਼ ਕਰ ਸਕਦੇ ਹਾਂ ਕਿ ਤੁਹਾਡਾ ਸੱਤਰ ਹੋ ਜਾਵੇ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਜੀ ਤੁਹਾਨੂੰ ਆ ਆਪਣੀ ਡਾਇਟ ਵੱਲ ਧਿਆਨ ਦੇਣਾ ਪਵੇਗਾ ਤੁਹਾਨੂੰ ਜਮਾਂ ਹੀ ਬਾਹਰਲਾ ਖਾਣਾ ਪੀਣਾ ਬਿਲਕੁਲ ਬੰਦ ਕਰਨਾ ਪੈਣਾ ਕਦੇ ਨਹੀਂ ਖਾਣਾ ਤੁਸੀਂ ਚਲੋ ਠੀਕ ਆ ਨਾਲੇ ਬਾਹਰਲਾ ਆਪਣੀ ਸਿਹਤ ਲਈ ਵੀ ਵਧੀਆ ਨਹੀਂ ਹੁੰਦਾ ਉਹ ਬਿਲਕੁਲ ਬੰਦ ਕਰਨਾ ਅਤੇ ਤਲਿਆ ਵੀ ਨਹੀਂ ਖਾਣਾ ਸਭ ਤੋਂ ਵੱਧ ਵੈਜੀਟੇਬਲਸ ਖਾ ਲਿਓ ਤੁਸੀਂ ਹੈ ਨਾ ਅਤੇ ਸਲਾਦ ਖਾ ਲਿਓ ਖੀਰੇ ਵਗੈਰਾ ਦਾ ਅਤੇ ਕਾਫੀ ਪੀ ਲਈ ਹਾਂਜੀ ਕਾਫੀ ਪੀ ਲਈ ਜਾਂ ਫਿਰ ਤੁਸੀਂ ਗ੍ਰੀਨ ਟੀ ਪੀ ਲਈ ਇਹਨਾਂ ਚੀਜ਼ਾਂ ਵੱਲ ਤੁਸੀਂ ਵੀ ਧਿਆਨ ਦੇ ਸਕਦੇ ਹੋ ਜੀ ਮੈਂ ਤੁਹਾਨੂੰ ਸ਼ਾਮ ਨੂੰ ਫਰੀ ਹੋ ਸਕਦੀ ਹਾਂ ਤੁਹਾਡੇ ਵਾਸਤੇ ਪੰਜ ਤੋਂ ਛੇ ਹਾਂਜੀ ਮੈਮ ਅਤੇ ਤੁਹਾਨੂੰ ਸਟਾਰਟਿੰਗ ਦੇ ਵਿੱਚ ਤੁਹਾਡੀ ਜੀ ਸਾਈਕਲਿੰਗ ਹੋਵੇਗੀ ਤੁਹਾਡੀ ਥੋੜ੍ਹੀਆਂ ਬਹੁਤ ਐਕਸਰਸਾਈਜ਼ ਹੋਣਗੀਆਂ ਕਾਡੀਓ ਹੋਵੇਗਾ ਅਤੇ ਹੌਲੀ ਹੌਲੀ ਕਰਕੇ ਇਹ ਚੀਜ਼ਾਂ ਤੁਹਾਡੀਆਂ ਅੱਗੇ ਵੱਧ ਜਾਣਗੀਆਂ ਮਸਲਸ ਦੇ ਵਿੱਚ ਆ ਜਾਓ ਮਸਲਸ ਨਾਲ ਤੁਹਾਨੂੰ ਜਿਹੜਾ ਵਰਕਆਊਟ ਆ ਉਹ ਕਰਾਉਣਾ ਤੁਹਾਨੂੰ ਸ਼ੁਰੂ ਕਰ ਦਾਂਗੇ ਹੌਲੀ ਹੌਲੀ ਵਧਾਵਾਂਗੀ ਹਰ ਚੀਜ਼ ਕਿਉਂਕਿ ਹਜੇ ਤੁਹਾਡਾ ਵੇਟ ਵੀ ਜ਼ਿਆਦਾ ਵਾ ਤਾਂ ਕਰਕੇ ਹੌਲੀ ਹੌਲੀ ਅੱਗੇ ਜਿਹੜੀਆਂ ਸਾਰੀਆਂ ਚੀਜ਼ਾਂ ਵਧਾਵਾਂਗੇ ਅਤੇ ਤੁਸੀਂ ਬਾਹਰਲਾ ਜਮਾਂ ਨਹੀਂ ਖਾਣਾ ਤੁਸੀਂ ਅੱਜ ਤੋਂ ਹੀ ਜਿਹੜਾ ਹੈਗਾ ਉਹ ਘਰ ਦਾ ਖਾਣਾ ਸ਼ੁਰੂ ਕਰ ਦਿਓ ਹਾਂਜੀ ਹਾਂਜੀ ਹਾਂਜੀ ਤੁਸੀਂ ਬਿਲਕੁਲ ਕਰ ਸਕਦੇ ਹੋ ਇਹ ਤਾਂ ਵਧੀਆ ਗੱਲ ਆ ਵੀ ਆਪਣੇ ਥੋੜ੍ਹਾ ਆਪਣਾ ਸਰੀਰ ਵੀ ਵਧੀਆ ਰਹਿੰਦਾ ਤਾਜ਼ਾ ਤੰਦਰੁਸਤ ਇਹ ਤਾਂ ਸਭ ਕੁਝ ਸਹੀ ਆ ਤੁਸੀਂ ਕਦੋਂ ਤੋਂ ਜੁਆਇਨ ਕਰਨਾ ਚਾਹੁੰਦੇ ਹੋ ਠੀਕ ਹਾਂਜੀ ਤੁਹਾਨੂੰ ਅਸੀਂ ਡਾਇਟ ਚਾਰਟ ਤੁਹਾਨੂੰ ਪ੍ਰੋਪਰ ਅਸੀਂ ਬਣਾ ਕੇ ਦੇਵਾਂਗੇ ਅਤੇ ਨਾਲ ਤੁਹਾਨੂੰ ਥੋੜ੍ਹੇ ਕੁ ਟਾਈਮ ਬਾਅਦ ਤੁਹਾਨੂੰ ਸਪਲੀਮੈਂਟਸ ਵੀ ਅਸੀਂ ਦੇਵਾਂਗੇ ਤੁਸੀਂ ਉਹ ਵੀ ਲੈਣੀ ਆ ਹਾਂ ਹਾਂਜੀ ਦਵਾਈਆਂ ਜਿਹੜੀਆਂ ਸਪਲੀਮੈਂਟਸ ਆ ਇਹ ਜਿਵੇਂ ਕਿ ਹੋ ਗਈ ਮਲਟੀਵਿਟਾਮਿਨ ਹੋ ਗਈ ਅਤੇ ਡੀ ਥ੍ਰੀ ਹੋ ਗਈ ਇਹ ਤਾਂ ਸਾਡੀ ਬਾਡੀ ਲਈ ਬਹੁਤ ਜ਼ਰੂਰੀ ਹੁੰਦੀਆਂ ਇਹ ਤਾਂ ਕੋਈ ਨੋਰਮਲ ਇਨਸਾਨ ਵੀ ਹਰ ਕੋਈ ਖਾ ਸਕਦਾ ਇਹਦੇ ਕੋਈ ਸਾਈਡ ਇਫੈਕਟ ਨਹੀਂ ਹੁੰਦੇ ਕੋਈ ਵੀ ਕੋਈ ਹੋਰ ਵੱਖਰੀ ਚੀਜ਼ ਨਹੀਂ ਹੁੰਦੀ ਕੋਈ ਐਲਰਜੀ ਵਗੈਰਾ ਕੁਛ ਨਹੀਂ ਹੁੰਦਾ ਇਹਨਾਂ ਨਾਲ ਇਹ ਨਹੀਂ ਜੀ ਤੁਹਾਨੂੰ ਹਜੇ ਪ੍ਰੋਟੀਨ ਦੀ ਤਾਂ ਕੋਈ ਲੋੜ ਨਹੀਂ ਹੈਗੀ ਹਾਂਜੀ ਤੁਸੀਂ ਪ੍ਰੋਟੀਨ ਹਜੇ ਨਹੀਂ ਲੈਣਾ ਤੁਸੀਂ ਹਜੇ ਸਟਾਰਟਿੰਗ ਕਰਨੀ ਆ ਜਦੋਂ ਮੈਨੂੰ ਲੱਗਿਆ ਵੀ ਤੁਹਾਨੂੰ ਲੋੜ ਹੈਗੀ ਉਦੋਂ ਮੈਂ ਤੁਹਾਨੂੰ ਦੱਸ ਦੇਵਾਂਗੀ ਤੁਸੀਂ ਲਓ ਅਤੇ ਉਹ ਵੀ ਤੁਹਾਨੂੰ ਮੈਂ ਦੱਸੂਗੀ ਜੀ ਤੁਸੀਂ ਕਿਹੜਾ ਲੈਣਾ ਤੁਸੀਂ ਉਹ ਹੀ ਲੈਣਾ ਹਾਂਜੀ ਮੈਂ ਤੁਹਾਨੂੰ ਘਰ ਆ ਕੇ ਕਰਵਾ ਦੂੰਗੀ ਲੇਕਿਨ ਤੁਸੀਂ ਇੱਕ ਵਾਰ ਮੈਨੂੰ ਆਪ ਆ ਕੇ ਮਿਲ ਲਓ ਮੇਰੀ ਜਿਮ 'ਚ ਤਾਂ ਕਿ ਆਪਾਂ ਜਿਹੜੀ ਹੈਗੀ ਆ ਆਹਮਣੇ ਸਾਹਮਣੇ ਬਹਿ ਕੇ ਗੱਲ ਕਰ ਲਈਏ ਤਾਂ ਕਿ ਜਿਹੜੇ ਕੋਈ ਆਪਣੇ ਡਾਊਟ ਹੋਏ ਜੇ ਤੁਹਾਡਾ ਕੋਈ ਹੋਰ ਹੋਇਆ ਇਸ਼ੂ ਤੁਸੀਂ ਮੈਨੂੰ ਦੱਸ ਸਕਦੇ ਹੋ ਅਤੇ ਮੈਂ ਤੁਹਾਨੂੰ ਉਹ ਦੱਸ ਦੂੰਗੀ ਵੀ ਕਿਹੜੀ ਚੀਜ਼ ਕਿੱਦਾਂ ਕਰਨੀ ਆ ਹਾਂਜੀ ਹਾਂਜੀ ਮੈਮ ਬਿਲਕੁਲ ਮੈਂ ਤੁਹਾਨੂੰ ਵਟਸਐਪ ਕਰ ਦਿੰਦੀ ਹਾਂ ਤੁਸੀਂ ਆ ਕੇ ਮੈਨੂੰ ਮਿਲ ਲਿਓ ਕੱਲ੍ਹ ਹਾਂਜੀ ਹਾਂਜੀ ਧੰਨਵਾਦ ਜੀ ਧੰਨਵਾਦ